ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਫੇਮਸ ਐਥਲੀਟ ਜਿਹਦਾ ਨਾਮ ਹੈ ਪੀ ਟੀ ਊਸ਼ਾ ਹਾਂਜੀ ਮੈਂ ਨਿੱਜੀ ਤੌਰ 'ਤੇ ਆਪਣੀ ਗੱਲ ਕਰਾਂ ਤਾਂ ਮੈਂ ਪੀ ਟੀ ਊਸ਼ਾ ਤੋਂ ਬਹੁਤ ਪ੍ਰਭਾਵਿਤ ਹੁੰਦਾ ਹਾਂ ਪੀ ਟੀ ਊਸ਼ਾ ਤੋਂ ਆ ਪੀ ਟੀ ਊਸ਼ਾ ਦੇ ਜ਼ਿੰਦਗੀ ਤੋਂ ਜਾਂ ਜੀਵਨ ਤੋਂ ਆਪਾਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਪੀ ਟੀ ਊਸ਼ਾ ਦਾ ਜਨਮ ਸਤਾਈ ਜੂਨ ਉੱਨੀ ਸੌ ਚੌਂਹਟ ਵਿੱਚ ਕੇਰਲਾ ਵਿਖੇ ਹੋਇਆ ਇਹਨਾਂ ਨੇ ਆਪਣਾ ਜਿਹੜਾ ਜੀਵਨ ਹੈ ਉਹ ਸਾਰਾ ਜੀ ਮਤਲਬ ਜੀਵਨ ਦੇ ਪਹਿਲੇ ਪੜਾਅ ਬਚਪਨ ਗਰੀਬੀ ਵਿੱਚ ਬਤੀਤ ਕੀਤਾ ਬਟ ਫਿਰ ਵੀ ਉਹ ਕਹਿੰਦੇ ਹਨ ਹੈ ਨਾ ਅਗਰ ਕੋਈ ਕੰਮ ਕਰਨ ਦਾ ਜਜ਼ਬਾ ਹੋਵੇ ਤਾਂ ਪਰਮਾਤਮਾ ਵੀ ਆਪਾਂ ਨੂੰ ਉਸ ਕੰਮ ਕਰ ਉਹ ਉਹ ਕੰਮ ਕਰਨ ਲਈ ਉਹਨਾਂ ਆ ਆਪਾਂ ਨੂੰ ਹੌਸਲਾ ਦਿੰਦਾ ਜਾਂ ਆਪਣਾ ਸਾਥ ਦਿੰਦਾ ਉਹ ਹੀ ਗੱਲ ਜਿਹੜੀ ਹੈ ਉਹ ਪੀ ਟੀ ਊਸ਼ਾ ਜੀ ਨਾਲ ਹੋਈ ਪੀ ਟਾ ਪੀ ਟੀ ਜੀ ਨੇ ਜਿਹਨੂੰ ਆਪਾਂ ਅੱਜ ਆਪਾਂ ਉੱਡਣ ਪਰੀ ਦੇ ਨਾਂ ਤੋਂ ਜਾਣਦੇ ਹਾਂ ਕਿਉਂ ਜਾਣਦੇ ਹਾਂ ਕਿਉਂਕਿ ਉੱਨੀ ਸੌ ਅੱਸੀ ਦੇ ਦਰਸ਼ਕਾਂ ਵਿੱਚ ਇਹਨਾਂ ਨੇ ਏਸ਼ੀਅਨ ਗੇਮ ਦੇ ਵਿੱਚ ਸਤਾਈ ਗੋਲਡ ਮੈਡਲ ਤੇਰ੍ਹਾਂ ਚੌਦਾਂ ਸਿਲਵਰ ਮੈਡਲ ਹਾਸਿਲ ਕੀਤੇ ਉਸ ਟਾਈਮ ਜਿੰਨੇ ਵੀ ਸਪੋਰਟਸ ਹੋਏ ਸਾਰਿਆਂ ਦੇ ਵਿੱਚ ਇਹਨਾਂ ਨੇ ਗੋਲਡ ਮੈਡਲਜ਼ ਜਾਂ ਮੈਡਲ ਦੀ ਲੜੀ ਲਾ ਦਿੱਤੀ ਇਸ ਕਰਕੇ ਇਹਨਾਂ ਨੂੰ ਪੰਜਾਬ ਸਰਕਾਰ ਨੇ ਅਰਜੁਨ ਅਵਾਰਡ ਤੋਂ ਸ ਨਿਵਾਜਿਆ ਉਸ ਤੋਂ ਬਾਅਦ ਇਹਨਾਂ ਨੂੰ ਮੈਂਬਰ ਆਫ ਰਾਜ ਸਭਾ ਵੀ ਚੁਣਿਆ ਗਿਆ ਅੱਜ ਆਪਾਂ ਕਈ ਗੱਲ ਕਰੀਏ ਤਾਂ ਅਗਰ ਮਿਲਖਾ ਸਿੰਘ ਹੋ ਗਿਆ ਜਾਂ ਪੀ ਟੀ ਊਸ਼ਾ ਹੋ ਗਏ ਇਹ ਜਿਹੇ ਚਾਰ ਪੰਜ ਨਾਮ ਹੈਗੇ ਆ ਜਿਨ੍ਹਾਂ ਕਰਕੇ ਆਪਾਂ ਨੂੰ ਐਥਲੀਟ ਦਾ ਇੱਕ ਨਵਾਂ ਜਜ਼ਬਾ ਪੰਜਾਬ ਭਾਰਤ ਵਿੱਚ ਪੈਦਾ ਹੋਇਆ ਮੈਨੂੰ ਨਿੱਜੀ ਤੌਰ 'ਤੇ ਪੀ ਟੀ ਊਸ਼ਾ ਜੀ ਦੇ ਜੀਵਨ ਨਾਲ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਅਗਰ ਆਪਣੇ ਅੰਦਰ ਜਜ਼ਬਾ ਹੋਵੇ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ ਉਹ ਚਾਰ ਸੌ ਮੀਟਰ ਜਾ ਲੰਬੀ ਦੌੜ ਦੀ ਦੌੜਸ ਦੌੜ ਦੌੜਕ ਸੀ ਉਹਨਾਂ ਨੇ ਭਾਰਤ ਦਾ ਨਾਂ ਭਾਰਤ ਦੇ ਵਿੱਚ ਹੀ ਨਹੀਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਬਹੁਤ ਰੋਸ਼ਨ ਕੀਤਾ ਉਹਨਾਂ ਦੇ ਜੀਵਨ ਤੋਂ ਆਪਾਂ ਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਗਰੀਬੀ ਆਪਣੇ ਘਰ ਦੀ ਹੋ ਸਕਦੀ ਹੈ ਬਟ ਆਪਣੇ ਜੀਵਨ ਆਪਾਂ ਜੇਕਰ ਚਾਹੀਏ ਤਾਂ ਆਪਾਂ ਆਪਣੀ ਗਰੀਬੀ ਨੂੰ ਆਪਣੇ ਹੌਸਲੇ ਨਾਲ ਖਤਮ ਕਰ ਸਕਦੇ ਹਾਂ ਉਹ ਵੀ ਇੱਕ ਪਰਿਵਾਰ ਗਰੀਬ ਪਰਿਵਾਰ ਤੋਂ ਆਈ ਬਟ ਉਹਨਾਂ ਨੇ ਆਪਣੀ ਮਿਹਨਤ ਸਦਕਾ ਏਸ਼ੀਆ ਦੇ ਵਿੱਚ ਜਾਂ ਪੂਰੇ ਹਿੰਦੂ ਪੂਰੇ ਭਾ ਪੂਰੀ ਦੁਨੀਆਂ ਦੇ ਵਿੱਚ ਆਪਣੇ ਭਾਰਤ ਦਾ ਨਾਂ ਰੋਸ਼ਨ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਡੀ ਐਸ ਪੀ ਵੀ ਬਤੋਰ ਨਿਯੁਕਤ ਕੀਤਾ ਗਿਆ ਇਹ ਜਿਹੜੀਆਂ ਗੱਲਾਂ ਹਨ ਮੈਂ ਨਿੱਜੀ ਤੌਰ 'ਤੇ ਪੀ ਪੀ ਟੀ ਜੀ ਊਸ਼ਾ ਜੀ ਬਾਰੇ ਜਾਣਦਾ ਹਾਂ